ਹੈਲੋ ਰਵੀ ਟਰੈਵਲ ਅਸੀਂ ਇਹ ਪਤਾ ਕਰਨਾ ਚਾਹੁੰਦੇ ਹਾਂ ਵੀ ਤੁਹਾਡੇ ਕੋਲ ਕੋਈ ਕੈਬ ਫਰੀ ਹੈਗੀ ਹੈ ਸਾਨੂੰ ਦੋ ਦਿਨ ਦੇ ਲਈ ਕੈਬ ਚਾਹੀਦੀ ਆ ਜਿਹਦੇ ਵਿੱਚ ਕਿ ਸਾਨੂੰ ਡਰਾਇਵਰ ਦੀ ਜ਼ਰੂਰਤ ਨਹੀਂ ਹੈਗੀ ਅਸੀਂ ਦੋ ਦਿਨ ਦੇ ਲਈ ਸਫਰ ਕਰਨਾ ਚਾਹੁੰਦੇ ਸਾਨੂੰ ਸੈਵਨ ਸੀਟਰ ਕੈਬ ਆ ਜਿਹੜੀ ਉਹ ਚਾਹੀਦੀ ਆ ਤੁਸੀਂ ਸਾਨੂੰ ਇਹ ਦੱਸ ਦਿਉ ਕਿ ਤੁ ਤੁਹਾਡਾ ਕਿਲੋਮੀਟਰ ਦਾ ਕਿਨ ਪ੍ਰਤੀ ਕਿਲੋਮੀਟਰ ਕਿੰਨਾ ਪੈਸੇ ਲਉਗੇ